ਇੱਕ ਜਨਵਰੀ ਦੋ ਹਜ਼ਾਰ ਚਾਰ ਦੋ ਸਤੰਬਰ ਦੋ ਹਜ਼ਾਰ ਪੰਜ ਤਿੰਨ ਨਵੰਬਰ ਦੋ ਹਜ਼ਾਰ ਅੱਠ ਚਾਰ ਮਾਰਚ ਦੋ ਹਜ਼ਾਰ ਗਿਆਰਾਂ ਪੰਜ ਜੂਨ ਦੋ ਹਜ਼ਾਰ ਅਠਾਰਾਂ